ਆਪਣੇ ਘਰ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸਾਫ ਰੱਖਣ ਲਈ ਬਹੁਤ ਸਾਰੇ ਉਪਾਅ ਕਰ ਸਕਦੇ ਹਾਂ ਜਿਵੇਂ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਨਿਯਮਿਤ ਸਫਾਈ ਕਰਨੀ ਚਾਹੀਦੀ ਹੈ ਘਰ ਦੇ ਆਲੇ ਦੁਆਲੇ ਗੰਦਗੀ ਜਮ੍ਹਾਂ ਨਹੀਂ ਹੋਣ ਦੇਣੀ ਚਾਹੀਦੀ ਧੂਲ ਮਿੱਟੀ ਨਹੀਂ ਜਮ੍ਹਾਂ ਹੋਣ ਦੇਣੀ ਚਾਹੀਦੀ ਅਤੇ ਕੂੜਾ ਕਰਕਟ ਜਮ੍ਹਾਂ ਨਾ ਹੋਣ ਦਿਓ ਜਿੰਨਾ ਹੋ ਸਕੇ ਕੂੜੇ ਕਰਕਟ ਨੂੰ ਬਾਹਰ ਸੁੱਟ ਕੇ ਉਸਦਾ ਨਿਪਟਾਰਾ ਕਰੋ ਘਰ ਦੇ ਆਲੇ ਦੁਆਲੇ ਕਿਤੇ ਵੀ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ ਇਸ ਨਾਲ ਮੱਛਰਾਂ ਦੀ ਉਤਪੱਤੀ ਹੁੰਦੀ ਹੈ ਗੰਦਗੀ ਫੈਲਦੀ ਹੈ ਅਤੇ ਬਿਮਾਰੀਆਂ ਵੀ ਫੈਲਦੀਆਂ ਹਨ ਘਰ ਦੇ ਆਲੇ ਦੁਆਲੇ ਰੋਜ਼ਾਨਾ ਝਾੜੂ ਨਾਲ ਸਾਫ ਸਫਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਗੁਆਂਢੀਆਂ ਨੂੰ ਵੀ ਇਸ ਲਈ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਆਲਾ ਦੁਆਲਾ ਸਾਫ ਰੱਖਣ